ਮੈਨੂੰ ਚਿੱਤਰਕਾਰੀ ਦਾ ਸ਼ੌਕ ਹੈ ਪਰ ਮੈਨੂੰ ਮੈਂ ਇੰਨੀ ਪਰਫੈਕਟ ਨਹੀਂ ਹਾਂ ਅਗਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਵਰਕਸ਼ੋਪ ਜ਼ਾਂ ਉਹਦੀ ਕੋਈ ਕਲਾਸ ਲਗਾਉਣਾ ਜ਼ਰੂਰ ਪਸੰਦ ਕਰੂੰਗੀ ਸਾਨੂੰ ਸਕੂਲ ਦੇ ਵਿੱਚ ਕਲਾਸ ਲੱਗਦੀ ਹੁੰਦੀ ਸੀ ਪਰ ਮੈਨੂੰ ਇੰਨੀ ਪਰਫੈਕਟ ਵਿੱਚ ਡਰਾਇੰਗ ਨਹੀਂ ਆਉਂਦੀ ਸੀ ਤਾਂ ਕਰਕੇ ਮੈਂ ਇੰਨੀ ਪਰਫੈਕਟ ਨਹੀਂ ਹੋ ਪਾਈ ਮੈਨੂੰ ਸ਼ੌਕ ਹੈ ਪਰ ਮੇਰੇ ਕੋਲ ਟਾਈਮ ਘੱਟ ਹੁੰਦਾ ਸੀ ਪਰ ਅਗਰ ਮੈਂ ਪ੍ਰੈਕਟਿਸ ਕਰਾਂ ਤਾਂ ਮੇਰੇ ਕੋਲ ਟਾਈਮ ਜ਼ਿਆਦਾ ਕੱਢ ਕੇ ਤਾਂ ਮੈਂ ਪਰਫੈਕਟ ਹੋ ਸਕਦੀ ਹਾਂ ਚਿੱਤਰਕਾਰੀ ਦੇ ਵਿੱਚ